ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਆਕਾਲ ਹਾਂਜੀ ਜੀ ਮੇਰਾ ਨਾਮ ਮਨਪ੍ਰੀਤ ਕੌਰ ਹੈ ਹਾਂਜੀ ਜੀ ਅਸੀਂ ਇੱਥੋਂ ਦੇ ਲੋਕਲ ਹੀ ਹਾਂ ਆਪਾਂ ਇੱਥੇ ਜਦੋਂ ਵੀ ਕੋਈ ਘਰ ਫੰਕਸ਼ਨ ਹੋਏ ਕਿਸੇ ਦੇ ਆਪਾਂ ਹਰ ਇੱਕ ਚੀਜ਼ ਇੱਥੋਂ ਲੈ ਕੇ ਜਾਂਦੇ ਹਾਂ ਉਹਨਾਂ ਦੀ ਇੱਕ ਇੱਕ ਬਹੁਤ ਹੀ ਵਧੀਆ ਹੁੰਦੇ ਆ ਤੁਸੀਂ ਔਡਰ ਦੇਖ ਕੇ ਇੰਨੀ ਕੁ ਇਹਨਾਂ ਦੀ ਡਿਲੀਵਰੀ ਫਾਸਟ ਆ ਕਿ ਅੱਜ ਹੀ ਸਾਹਮਣੇ ਸਵੇਰੇ ਔਡਰ ਦੇ ਕੇ ਜਾਓਗੇ ਤੁਹਾਨੂੰ ਮਤਲਬ ਇੱਕ ਦੋ ਘੰਟਿਆਂ ਦੇ ਵਿੱਚ ਤੁਹਾਨੂੰ ਮਤਲਬ ਕੇਕ ਤੁਹਾਡਾ ਤਿਆਰ ਮਿਲੇਗਾ ਇੰਨਾ ਹਾਂਜੀ ਜੀ ਹਾਂਜੀ ਜੀ ਉਹ ਕੋਈ ਨਵਾਂ ਹੈ ਨਾ ਕੋਈ ਉਹ ਬੇਕਰੀ ਦਾ ਸਾਰਾ ਸਮਾਨ ਉਹਨਾਂ ਸਾਰਾ ਕੁਛ ਇਹਨਾਂ ਦਾ ਆਪ ਇਹਨਾਂ ਦਾ ਆਪ ਬਣਵਾਉਂਦੇ ਆ ਇਹਨਾਂ ਦੀ ਅਲੱਗ ਹੀ ਪਿੱਛੇ ਇਹਨਾਂ ਦੀ ਬੇਕਰੀ ਦੀ ਸੌਪ ਆ ਅਤੇ ਇਹਨਾਂ ਦੇ ਬਰੈੱਡ ਬਿਸਕਿਟ ਸਭ ਕੁਝ ਇਹਨਾਂ ਕੋਲ ਅਵੇਲੇਬਲ ਸਭ ਮਿਲ ਜਾਂਦਾ ਹਰੇਕ ਚੀਜ਼ ਲੈਣ ਆਓਗੇ ਤੁਸੀਂ ਸਾਰਾ ਕੁਛ ਹੀ ਬਰਥਡੇ ਦਾ ਸਮਾਨ ਕੁਝ ਵੀ ਇਹਨਾਂ ਨੇ ਜੀ ਅੱਜ ਕੱਲ੍ਹ ਤਾਂ ਇਹਨਾਂ ਨੇ ਸਭ ਕੁਝ ਹੀ ਰੱਖ ਲਿੱਤਾ ਹੋਇਆ ਵਾ ਜੋ ਅੱਜ ਕੱਲ੍ਹ ਤੁਹਾਨੂੰ ਪਤਾ ਵਾ ਖਾਣ ਪੀਣ ਦੀਆਂ ਚੀਜ਼ਾਂ ਹੁੰਦੀਆਂ ਸਭ ਬਿਸਕਿਟ ਰੱਖ ਲਏ ਇਹਨਾਂ ਨੇ ਔਡਰ 'ਤੇ ਪੇਸਟੀਜ਼ ਮਿਲਦੀਆਂ ਕੱਪ ਕੇਕ ਮਿਲ ਜਾਂਦੇ ਇਹਨਾਂ ਕੋਲ ਬਿਸਕਿਟ ਮਿਲ ਜਾਂਦੇ ਆ ਕਾਫੀ ਚੀਜ਼ਾਂ ਹੈ ਨਹੀਂ ਉਹ ਆਪ ਬਣਾਉਂਦੇ ਆ ਹਾਂਜੀ ਹਾਂਜੀ ਵੀ ਬਹੁਤ ਜ਼ਿਆਦਾ ਹੈ ਇਹਨਾਂ ਦਾ ਹਾਂਜੀ

ਇਹਨਾਂ ਦਾ ਜ਼ਾਈਕਾ ਬਹੁਤ ਸਵਾਦ ਹਾਂਜੀ ਇਹਨਾਂ ਦਾ ਜ਼ਾਈਕਾ ਬਹੁਤ ਵਧੀਆ ਧੰਨਵਾਦ